ਤਰਨ ਤਾਰਨ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ ਕਾਫੀ ਲੋਕ ਆਪਣੀ ਸਿਹਤ ਨੂੰ ਲੈ ਕੇ ਮਤਲਬ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਅਤੇ ਸਿਹਤ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਬਿਨਾਂ ਇਨਸਾਨ ਸਰਵਾਈਵ ਕਰ ਹੀ ਨਹੀਂ ਸਕਦਾ ਅਗਰ ਉਹਦੀ ਸਿਹਤ ਨਹੀਂ ਚੰਗੀ ਹੋਵੇਗੀ ਉਹਦਾ ਦਿਨ ਵੀ ਨਹੀਂ ਚੰਗਾ ਜਾਵੇਗਾ ਅੱਗੇ ਜਾ ਕੇ ਉਹਦੀ ਲਾਈਫ ਹੀ ਖਰਾਬ ਹੀ ਜਾਵੇਗੀ ਕਹਿੰਦੇ ਆ ਨਾ ਕਿ ਹੈਲਥ ਇਜ ਵੈਲਥ ਅਤੇ ਕਾਫੀ ਜ਼ਿਆਦਾ ਜਿਹੜੇ ਸੁਝਾਵ ਆ ਲੋਕਾਂ ਨੂੰ ਅਪਣਾਉਣੇ ਚਾਹੀਦੇ ਜਿੱਦਾਂ ਆਪਾਂ ਨੋਰਮਲੀ ਹੋਸਪਿਟਲਸ 'ਚ ਜਾਂਦੇ ਹਾਂ ਉੱਥੇ ਨਰਸਿਸ ਡਾਕਟਰਜ ਨੇ ਮਾਸਕ ਪਹਿਨੇ ਹੁੰਦੇ ਆ ਹਾਂ ਪੇਸ਼ੈਂਟਸ ਨੂੰ ਉਹ ਯੂਜਲੀ ਪਹਿਨਾ ਦਿੰਦੇ ਆ ਥੋੜ੍ਹਾ ਥੋੜ੍ਹਾ ਕਰਕੇ ਮਤਲਬ ਪੇਸ਼ੈਂਟਸ ਨੂੰ ਪਹਿਨਾ ਦਿੰਦੇ ਆ ਬਟ ਜਿੱਦਾਂ ਕਦੇ ਕਦੇ ਵਿਜਿਟਰਸ ਆਏ ਆ ਉਹ ਮਾਸਕ ਨਹੀਂ ਲਗਾਉਂਦੇ ਜਾਂ ਫਿਰ ਪੇਸ਼ੈਂਟ ਦੇ ਰੂਮ ਵਿੱਚ ਚਲੇ ਜਾਂਦੇ ਉਹਨਾਂ ਦੀਆਂ ਚੀਜ਼ਾਂ ਨੂੰ ਟੱਚ ਕਰਦੇ ਆ ਮਤਲਬ ਜਿੱਦਾਂ ਕੋਈ ਵੀ ਆਪਾਂ ਹੁਣ ਐਪਲ ਵਗੈਰਾ ਲੈ ਕੇ ਗਏ ਹਾਂ ਆਪਣੇ ਪੇਸ਼ੈਂਟ ਵਾਸਤੇ ਤਾਂ ਮੈਨੂੰ ਲੱਗਦਾ ਉਹ ਚੀਜ਼ਾਂ ਨੂੰ ਸੈਨੀਟਾਈਜ਼ ਕਰਕੇ ਦੇਣਾ ਚਾਹੀਦਾ ਕਿਉਂਕਿ ਇੱਕ ਪੇਸ਼ੈਂਟ ਆ ਉਹਦੀ ਮਤਲਬ ਹੈਲਥ ਕਿੰਨੀ ਜ਼ਿਆਦਾ ਉਹ ਨਾਜ਼ੁਕ ਹੋ ਗਈ ਕਿ ਹੁਣ ਜਿੱਦਾਂ ਕੁਝ ਆਪਾਂ ਜਰਮਸ ਹੀ ਲੈ ਕੇ ਆ ਰਹੇ ਹਾਂ ਅਗਰ ਆਪਾਂ ਪ੍ਰੋਪਰਲੀ ਧਿਆਨ ਨਹੀਂ ਦੇਵਾਂਗੇ ਹੁਣ ਆਪਾਂ ਬੋਲਾਂਗੇ ਤਾਂ ਆਪਣੀ ਮੂੰਹ ਦੇ ਬੈਕਟੀਰੀਆਜ਼ ਜਿਹੜੇ ਉਹ ਆਉਂਦੇ ਆ ਬਾਹਰ ਅਤੇ ਮਤਲਬ ਉਹ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਹਨ ਜਿੱਦਾਂ ਲੋਕਾਂ ਨੂੰ ਮਾਸਕ ਪਾ ਕੇ ਜਾਣਾ ਚਾਹੀਦਾ ਹੈ ਹਾਂ ਜਦੋਂ ਕਰੋਨਾ ਟਾਈਮ ਆਇਆ ਹੈ ਲੋਕ ਕਿੰਨਾਂ ਜ਼ਿਆਦਾ ਮਤਲਬ ਸੈਨੀਟਾਈਜ਼ਰ ਯੂਜ ਕਰਦੇ ਸੀ ਮਾਸਕ ਲਾ ਕੇ ਜਾਂਦੇ ਸੀ ਉਹ ਵੀ ਉਹਨਾਂ ਨੂੰ ਬਹੁਤ ਹੀ ਇਰੀਟੇਟ ਲੱਗਦਾ ਕਿ ਕਿਉਂ ਯਾਰ ਕਿ ਕਿਉਂ ਮਾਸਕ ਲਗਾ ਕੇ ਜਾਣਾ ਪੈ ਰਿਹਾ ਵਾ ਸੈਨੀਟਾਈਜ਼ਰ ਨਾਲ ਬਾਰ ਬਾਰ ਸੈਨੀਟਾਈਜ਼ ਕਰਨਾ ਪੈ ਰਿਹਾ ਹੱਥ ਧੋਣੇ ਪੈ ਰਹੇ ਆ ਅਤੇ ਉਹ ਚੀਜ਼ਾਂ ਵਾ ਨਾ ਜਿਹੜੀਆਂ ਉਹ ਆਪਾਂ ਨੂੰ ਅਪਣਾਉਣੀਆਂ ਚਾਹੀਦੀਆਂ ਇਹ ਨਹੀਂ ਕਿ ਹਾਂ ਜਿੱਦਾਂ ਕੋਵਿਡ ਆਇਆ ਸੀ ਅਤੇ ਬੰਦਾ ਉਦੋਂ ਹੀ ਅਪਣਾਵੇ ਇਹ ਰੋਜ਼ ਰੋਜ਼ ਕਰਨਾ ਚਾਹੀਦਾ ਜਿੱਦਾਂ ਹੁਣ ਆਪਾਂ ਬਾਹਰੋਂ ਆਏ ਹਾਂ ਆਪਾਂ ਜਰਮਸ ਲੈ ਕੇ ਆਏ ਹਾਂ ਆਪਾਂ ਨੂੰ ਆ ਕੇ ਹੱਥ ਧੋਣੇ ਚਾਹੀਦੇ ਆ ਅਗਰ ਜ਼ਿਆਦਾ ਤੋਂ ਜ਼ਿਆਦਾ ਅਗਰ ਆਪਾਂ ਨਹਾਵਾਂਗੇ ਅਤੇ ਉਹ ਤਾਂ ਬਹੁਤ ਹੀ ਵਧੀਆ ਹੋ ਜਾਊਗਾ ਕਿ ਆਪਣੀ ਸਾਰੇ ਬੋਡੀਜ਼ 'ਚ ਜੋ ਵੀ ਜਮਸ ਵਗੈਰਾ ਆਪਾਂ ਬਾਹਰੋਂ ਲੈ ਕੇ ਆਏ ਬੈਕਟੀਰੀਆ ਉਹ ਬਾਹਰ ਨਿਕਲ ਜਾਣਗੇ ਫਿਰ ਜਿੱਦਾਂ ਆਪਾਂ ਹੋਸਪਿਟਲ 'ਚ ਜਾਂਦੇ ਹਾਂ ਜਾਂ ਮਤਲਬ ਹੋਸਪਿਟਲ 'ਚ ਅਤੇ ਇਹ ਚੀਜ਼ਾਂ ਤਾਂ ਬਹੁਤ ਧਿਆਨ ਰੱਖਣਾ ਚਾਹੀਦਾ ਜਿੱਦਾਂ ਆਪਾਂ ਜਾਂਦੇ ਹਾਂ ਅਤੇ ਆਪਾਂ ਨੂੰ ਮਾਸਕ ਵਗੈਰਾ ਪਹਿਨ ਕੇ ਜਾਣਾ ਚਾਹੀਦਾ ਵਾ ਹੋਰ ਵੀ ਕਾਫੀ ਚੀਜ਼ਾਂ ਦੀ ਲੋੜ ਆ ਬਦਲਣ ਦੀ ਜਿੱਦਾਂ ਕਿ ਜਿੱਦਾਂ ਹੁਣ ਆਪਾਂ ਕਿਸੇ ਲਈ ਫਰੂਟ ਵਗੈਰਾ ਵੀ ਲੈ ਕੇ ਗਏ ਹਾਂ ਪੇਸ਼ੈਂਟ ਵਾਸਤੇ ਕੁਛ ਲੈ ਕੇ ਗਏ ਹਾਂ ਅਤੇ ਆਪਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਉਹ ਚੀਜ਼ ਆਪਾਂ ਨੂੰ ਸੈਨੀਟਾਈਜ਼ ਕਰਕੇ ਦੇਣੀ ਚਾਹੀਦੀ ਜਿੱਦਾਂ ਆਈ ਸੀ ਯੂ ਵਿੱਚ ਪੇਸ਼ੈਂਟ ਹੁੰਦਾ ਵਾ ਅਤੇ ਆਪਾਂ ਮ ਮਤਲਬ ਆਪਣੇ ਆਪ ਨੂੰ ਸੈਨੀਟਾਈਜ਼ ਕਰਕੇ ਮਤਲਬ ਆਪਾਂ ਨੂੰ ਡੋਕਟਰ ਕਹਿੰਦੇ ਕਿ ਉੱਥੇ ਜਾਓ ਤਾਂ ਕਿ ਜਿੱਦਾਂ ਕਿ ਆਈ ਸੀ ਯੂ ਵਿੱਚ ਪੇਸ਼ੈਂਟ ਆ ਜ਼ਿਆਦਾਤਰ ਵੈਸੇ ਮਿਲਣ ਵੀ ਨਹੀਂ ਦਿੰਦੇ ਬਟ ਜੇ ਫਿਰ ਵੀ ਆ ਤਾਂ ਫਿਰ ਜਿੱਦਾਂ ਕੋਈ ਇਨਸਾਨ ਗਿਆ ਉਹਨੂੰ ਪੂਰਾ ਸਾ ਸੈਨੀਟਾਈਜ਼ ਕਰਕੇ ਜ ਮਤਲਬ ਜਾਣਾ ਪੈਂਦਾ ਤਾਂ ਕਿ ਜਦੋਂ ਉਹਦੇ ਬ ਬੋਡੀ ਦੇ ਬੈਕਟੀਰੀਆਜ਼ ਆ ਉਹ ਪੇਸ਼ੈਂਟ ਦੇ ਮਤਲਬ ਜਿਹੜੀ ਹੈਲਥ ਆਲਰੇਡੀ ਇੰਨੀ ਕੋਂਪਲੀਕੇਟਿਡ ਉਹਨੂੰ ਹੋਰ ਕੋਂਪਲੀਕੇਟਿਡ ਨਾ ਕਰ ਦੇਣ